ਭਾਰਤ ਦੀਆਂ ਸਰਕਾਰੀ ਭਾਸ਼ਾਵਾਂ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਹਨ ਔਰ ਸਾਰੀਆਂ ਸਮੁੱਚੀ ਭਾਸ਼ਾਵਾਂ ਵਿੱਚ ਤਾਮਿਲ ਤੇਲਗੂ ਬੰਗਾਲੀ ਕਸ਼ਮੀਰੀ ਕੱਨੜ ਵਗੈਰਾ ਵਗੈਰਾ ਸ਼ਾਮਿਲ ਹਨ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਇਸ ਵਿੱਚ ਉਨੱਤੀ ਤੋਂ ਵੀ ਜ਼ਿਆਦਾ ਰਾਜ ਹਨ ਹਰ ਰਾਜ ਦੀ ਆਪਣੀ ਆਪਣੀ ਕੋਈ ਬੋਲੀ ਜਾਂ ਭਾਸ਼ਾ ਹੈ ਜਿਹੜੀਆਂ ਇਹ ਭਾਸ਼ਾਵਾਂ ਹਨ ਇਹ ਪੂਰੇ ਭਾਰਤ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀ ਹੈ ਕਿਉਂਕਿ ਹਿੰਦੀ ਤਾਂ ਪੂਰੇ ਦੇਸ਼ ਵਿੱਚ ਬੋਲੀ ਜਾਂਦੀ ਹੈ ਪਰ ਜਿਹੜੀਆਂ ਰਾਜ ਦੀ ਆਪਣੀ ਆਪਣੀ ਭਾਸ਼ਾਵਾਂ ਹਨ ਉਹ ਰਾਜ ਨੂੰ ਆਪਣੀ ਸੰਸਕ੍ਰਿਤੀ ਤੋਂ ਜੋੜ ਕੇ ਰੱਖਦੀਆਂ ਹਨ ਆਪਣੇ ਇਤਿਹਾਸ ਤੋਂ ਜਿਹੜੀਆਂ ਭਾਸ਼ਾਵਾਂ ਕਿਸੇ ਵੀ ਪਰਟੀਕੁਲਰ ਰਾਜ 'ਚ ਬੋਲੀ ਜਾਂਦੀਆ ਹਨ ਉਹ ਸਾਨੂੰ ਉਹਦੇ ਪਾਸਟ ਵਗੈ ਬਾਰੇ ਦੱਸਦੀ ਹੈ ਅਤੇ ਉਹਦੀ ਸੰਸਕ੍ਰਿਤੀ ਕਿਸ ਤਰ੍ਹਾਂ ਦੀ ਰਹੀ ਹੈ ਪਹਿਲਾਂ ਅਤੇ ਅੱਗੇ ਉਹ ਕੀ ਕਰ ਸਕਦਾ ਹੈ ਉਹ ਸਾਨੂੰ ਪਤਾ ਚੱਲਦਾ ਹੈ ਭਾਸ਼ਾਈ ਵਿਭਿੰਨਤਾ ਪੂਰੇ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੀ ਹੈ ਹਾਲਾਂਕਿ ਇੱਕ ਭਾਸ਼ਾ ਹੋਣ ਨਾਲ ਦੇਸ਼ 'ਚ ਕੋਮਿਊਨੀਕੇਸ਼ਨ ਬਹੁਤ ਚੰਗੀ ਹੋ ਜਾਵੇਗੀ

ਜਦੋਂ ਭਾਸ਼ਾਵਾਂ ਵਿੱਚ ਵਿਭਿੰਨਤਾ ਪਾਈ ਜਾਵੇਗੀ ਸਾਡਾ ਦੇਸ਼ ਆਪਣੀ ਸੰਸਕ੍ਰਿਤੀ ਨਾਲ ਔਰ ਗਹਿਰੇ ਸਤਰ 'ਤੇ ਜੁੜੇਗਾ